ਮੈਨੂੰ ਲਿਖਣ ਅਤੇ ਪੜ੍ਹਨ ਦਾ ਜਿਹੜਾ ਸ਼ੌਂਕ ਸੀਗਾ ਉਹ ਮੇਰੀ ਉਮਰ 'ਚ ਹੀ ਬੜਾ ਲੇਟ ਲੱਗਿਆ ਜਦੋਂ ਮੈਂ ਅਠਾਰਾਂ ਕੁ ਸਾਲ ਦਾ ਸੀ ਤਕਰੀਬਨ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਲਈ ਪਹਿਲੇ ਵਰਾਂ ਆਪਣੀ ਸਟੇਟ ਤੋਂ ਬਾਹਰ ਗਿਆ ਸੀ ਤਾਂ ਉੱਥੇ ਮੈਂ ਲਾਇਬਰੇਰੀ 'ਚ ਬੈਠਿਆ ਅਤੇ ਮੈਂ ਬਹਿ ਕੇ ਵੇਖਿਆ ਸੋਚਿਆ ਐਕਸਪਲੋਰ ਕੀਤਾ ਜਾਣਿਆ ਸਮਝਿਆ ਉੱਥੇ ਮੈਨੂੰ ਪੜ੍ਹਨ ਦਾ ਥੋੜ੍ਹਾ ਸ਼ੌਂਕ ਲੱਗਿਆ ਮੈਨੂੰ ਪੜ੍ਹਨ ਦੀ ਤਰਬੀਅਤ ਆਈ ਅਤੇ ਪੜ੍ਹਨ ਦੀ ਸਮਝ ਆਈ ਜਦੋਂ ਮੈਂ ਪੜ੍ਹਨ ਲੱਗਾ ਅਤੇ ਜੇ ਮੈਂ ਪੜ੍ਹਿਆ ਤਾਂ ਮੈਂ ਮਹਿਸੂਸ ਕਰਨ ਲੱਗਾ ਜਦੋਂ ਤੁਸੀਂ ਅੱਖਰਾਂ ਨੂੰ ਪੜ੍ਹਦੇ ਹੋ ਜਦੋਂ ਤੁਸੀਂ ਸ਼ਾਂਤ ਬਹਿੰਦੇ ਹੋ ਤਾਂ ਤੁਸੀਂ ਚੀਜ਼ਾਂ ਨੂੰ ਮਹਿਸੂਸ ਕਰਨ ਦੀ ਜਿਹੜੀ ਕਾਬਲੀਅਤ ਹੈ ਉਹ ਪਾਉਂਦੇ ਹੋ ਅਤੇ ਉਹ ਸ਼ਾਂਤੀ ਨੇ ਅਤੇ ਉਸ ਕਾਬਲੀਅਤ ਨੇ ਅਤੇ ਉਸ ਆਬੋ ਹਵਾ ਨੇ ਅਤੇ ਉਹ ਸਾਰੀਆਂ ਜਿਹੜੀਆਂ ਘਟਨਾਵਾਂ ਮੇਰੇ ਜੀਵਨ 'ਚ ਵਾਪਰੀਆਂ ਵਾਪਰੀਆਂ ਜਿਵੇਂ ਮੈਂ ਕਿਵੇਂ ਇੱਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਸਕੂਲ 'ਚੋਂ ਆਇਆ ਫਿਰ ਇੱਕ ਵੱਡੀ ਯੂਨੀਵਰਸਿਟੀ 'ਚ ਦਾਖਲਾ ਲਿੱਤਾ ਪੇਪਰ ਦਿੱਤਾ ਤੇ ਜ਼ਿੰਦਗੀ 'ਚ ਜੋ ਵੀ ਚੰਗੇ ਮਾੜੇ ਅਹਿਸਾਸ ਹੋਏ ਅਤੇ ਪੜ੍ਹਨ ਕਰਕੇ ਅਤੇ ਗੰਭੀਰਤਾ ਕਰਕੇ ਅਤੇ ਧਿਆਨ ਕਰਕੇ ਇਨ੍ਹਾਂ ਸਾਰੀਆਂ ਚੀਜ਼ਾਂ ਕਰਕੇ ਮੈਨੂੰ ਲਿਖਣ ਦਾ ਵੀ ਸ਼ੌਂਕ ਪਿਆ ਅਤੇ ਮੈਂ ਆਪਣੀ ਮਨ ਦੀ ਓਹਾ ਪੋ ਸੀ ਜਿਹੜੀ ਉਠਾਅ ਭੜਕ ਸੀ ਉਹਨੂੰ ਦੂਰ ਕਰਨ ਲਈ ਕਦੇ ਕਾਗਜ਼ ਅਤੇ ਕਲਮ ਚੁੱਕਦਾ ਅਤੇ ਲਿਖਣਾ ਸ਼ੁਰੂ ਕਰ ਦਿੰਦਾ ਜੇ ਮੈਂ ਜ਼ਿਕਰ ਕਰਾਂ ਤਾਂ ਮੇਰੀ ਸਭ ਤੋਂ ਪਸੰਦੀਦਾ ਲਿਖਾਵਟ ਤਾਂ ਮੈਂ ਇੱਕ ਕਵਿਤਾ ਲਿਖੀ ਸੀ ਦਾ ਟੂ ਬਟਰਫਲਾਈ ਐਂਡ ਦਾ ਦਾਰਵਿਸ਼ ਇਹ ਅੰਗਰੇਜ਼ੀ 'ਚ ਲਿਖੀ ਮੇਰੀ ਇੱਕ ਰਚਨਾ ਹੈ ਇਹ ਮੈਂ ਉਦੋਂ ਲਿਖੀ ਸੀ ਜਦੋਂ ਇੱਕ ਵਰਾਂ ਸਰਦੀਆਂ ਦੇ ਮਗਰੋਂ ਜਦੋਂ ਆਪਾਂ ਬਸੰਤ ਕਹਿੰਦੇ ਆ ਬਸੰਦਾ ਦਾ ਚਰਸੀ ਫੁੱਲ ਖਿੜਨ ਲੱਗੇ ਸੀ ਉਹਦੇ 'ਤੇ ਇੱਕ ਜਿਵੇਂ ਫੁੱਲ ਦੇ ਵਾਰ ਵਾਰ ਜਿਵੇਂ ਤਿਤਲੀਆਂ ਅਤੇ ਭੋਰੇ ਮੰਡਰਾਉਂਦੇ ਹੈ ਅਤੇ ਇੱਕ ਬੜਾ ਹੀ ਖੂਬਸੂਰਤ ਗੁਲਾਬੀ ਰੰਗ ਦਾ ਫੁੱਲ ਸੀ ਗੁਲਾਬ ਦਾ ਉਹਦੇ ਵਾਰ ਵਾਰ ਦੋ ਸੁਨਹਿਰੇ ਰੰਗ ਦੀਆਂ ਤਿਤਲੀਆਂ ਮੰਡਰਾਉਣ ਲੱਗੀਆਂ ਸੀ ਉਹ ਤੇ ਉਹ ਉਹਨੂੰ ਚੱਕਰ ਕੱਟੀ ਜਾਂਦੀਆਂ ਸੀ ਵਾਰ ਵਾਰ ਐਂ ਸਰਕਲ ਕ ਕਰੀ ਜਾਂਦੀ ਸੀ ਉਹਦੀ ਅਤੇ ਉਹਨੂੰ ਦੇਖ ਕੇ ਮੈਨੂੰ ਜਿਵੇਂ ਸੂਫੀ ਨੱਚਦੇ ਆ ਜਿਵੇਂ ਸੂਫ਼ੀ ਘੇਰਾ ਬੰਨ੍ਹਦੇ ਆ ਅਤੇ ਉਹ ਨੱਚਦੇ ਨੱਚਦੇ ਘੁੰਮਦੇ ਘੁੰਮਦੇ ਰੱਬ ਦੇ ਵਿੱਚ ਉਹ ਰੱਬ ਪਾ ਲੈਂਦੇ ਦਰਸ਼ਨ ਕਰ ਲੈਂਦੇ ਉਸ ਹਿਸਾਬ ਨਾਲ ਮੈਨੂੰ ਲੱਗਿਆ ਕਿ ਜਿਵੇਂ ਇੱਕ ਆਸ਼ਕ ਹੁੰਦਾ ਹੈ ਪ੍ਰੇਮੀ ਹੁੰਦਾ ਉਹ ਕਿਵੇਂ ਆਪਣੇ ਪ੍ਰੇਮਿਕਾ ਨਾਲ ਉਹਦੇ ਵਿਚਾਰਾਂ 'ਚ ਉਹਦੇ ਆਲੇ ਦੁਆਲੇ ਘੁੰਮ ਕੇ ਕਿਵੇਂ ਉਹਦਾ ਇੱਕ ਹਿੱਸਾ ਹੋ ਜਾਂਦਾ ਤਾਂ ਇਹ ਸਭ ਸੀ ਜਿਹਨੇ ਮੈਨੂੰ ਲਿਖਣ ਨੂੰ ਪ੍ਰੇਰਿਤ ਕੀਤਾ ਅਤੇ ਮੈਂ ਲਿਖਣ 'ਚ ਹੀ ਮੈਂ ਪੰਜਾਬੀ ਹਿੰਦੀ ਉਰਦੂ ਅਤੇ ਅੰਗਰੇਜ਼ੀ ਚਾਰੋਂ ਜ਼ੁਬਾਨਾਂ ਜਾਣਦਾ ਹਾਂ ਤਾਂ ਕਰਕੇ ਮੈਂ ਇਹਨਾਂ ਚਾਰਾਂ ਭਾਸ਼ਾਵਾਂ 'ਚ ਲਿਖਦਾ ਹਾਂ ਅਕਸਰ ਮੈਂ ਬਹੁਤਾ ਤਾਂ ਅੰਗਰੇਜ਼ੀ ਜਾਂ ਫਿਰ ਉਰਦੂ 'ਚ ਵੀ ਲਿਖਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਵੱਖੋ ਵੱਖ ਭਾਸ਼ਾਵਾਂ 'ਚ ਲਿਖਣ ਲਿਖ ਸਕਦਾ